ਇੱਕ ਧਰਮ ਦੇ ਦੂਸਰੇ ਧਰਮ ਨਾਲ ਜਿਵੇਂ ਕਿ ਅਸੀਂ ਸਮਝਦੇ ਹਾਂ ਹਿੰਦੂ ਇੱਕ ਧਰਮ ਹੈ ਅਤੇ ਸਿੱਖ ਦੂਸਰਾ ਧਰਮ ਹੈ ਬੱਟ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਜਿਵੇਂ ਕਿ ਅਸੀਂ ਸਾਡੇ ਮੁਹੱਲੇ ਵਿੱਚ ਗੁਰਦੁਆਰਾ ਵੀ ਹੈ ਅਤੇ ਮੰਦਿਰ ਵੀ ਹੈ ਜਿਵੇਂ ਕਿ ਗੁਰਦੁਆਰੇ ਲੋਕ ਜਾਣ ਵਾਲੇ ਮੰਦਿਰ ਵੀ ਜਾਂਦੇ ਹਨ ਜਿਸ ਤਰ੍ਹਾਂ ਜਿਵੇਂ ਕਿ ਅਸੀਂ ਮੰਦਿਰ ਜਾਣ ਵਾਲੇ ਗੁਰਦੁਆਰੇ ਵੀ ਜਾਂਦੇ ਹਾਂ ਅਤੇ ਆਪਣੇ ਮੰ ਜਿਵੇਂ ਕਿ ਆਪਣੇ ਮੁਹੱਲੇ 'ਚ ਜਾਂ ਆਪਣੇ ਆਪਣੇ ਕਿਸੇ ਰਿਸ਼ਤੇਦਾਰਾਂ 'ਚ ਜਦੋਂ ਵੀ ਕਿਤੇ ਕਿਸੇ ਨੇ ਆਖੰਡ ਪਾਠ ਰਖਵਾਇਆ ਹੋਵੇ ਜਾਂ ਕੀਰਤਨ ਰਖਵਾਇਆ ਹੋਵੇ ਅਸੀਂ ਜਾਂਦੇ ਹਾਂ ਮਤਲਬ ਕਿਸ ਮਤਲਬ ਕਿ ਇੱਕ ਦੂਜੇ ਦੇ ਧਰਮ ਨੂੰ ਲੈ ਕੇ ਕੋਈ ਵੀ ਇੱਦਾਂ ਦੀ ਗੱਲ ਬਾਤ ਨਹੀਂ ਹੈ ਜਿਵੇਂ ਕਿ ਇੱਕ ਦੂਜੇ ਨੂੰ ਭੜਕਾਉਣਾ ਜਾਂ ਦੱਸਣਾ ਕਿ ਇਸਦਾ ਧਰਮ ਗਲਤ ਹੈ ਜਾਂ ਉਸਦਾ ਗਲਤ ਹੈ ਬੱਟ ਜਿਵੇਂ ਕਿ ਜਿਵੇਂ ਕਿ ਮਤਲਬ ਸਾਰੇ ਰਲ ਮਿਲ ਕੇ ਰਹਿੰਦੇ ਹਾਂ ਪੰਜਾਬ ਇੱਕ ਹਿੰਦੂ ਅਤੇ ਸਿੱਖ ਪਰਿਵਾ ਪਰਿਵਾਰ ਦੀ ਤਰ੍ਹਾਂ ਮਤਲਬ ਹੈ ਆਪਣੇ ਪੰਜਾਬ ਜਿਸ ਨੂੰ ਕਿ ਲੋਕ ਮਤਲਬ ਇੱਕ ਦੂਜੇ ਦੇ ਜਾਂ ਇੱਕ ਦੂਸਰੇ ਧਰਮ ਨੂੰ ਭੜਕਾਉਣਾ ਜਾਂ ਕਿਸੇ ਦੇ ਬਾਰੇ ਗਲਤ ਗੱਲਾਂ ਕਰਨੀਆਂ ਇਸ ਤਰ੍ਹਾਂ ਦਾ ਕੁਛ ਵੀ ਹੈ ਨਹੀਂ ਹੈ